ਬਾਲੀਵੁੱਡ ਟਾਲੀਵੁੱਡ ਨੇ ਭਾਰਤ ਵਿੱਚ ਹਰ ਥਾਂ ਫੈਸ਼ਨ ਰੁਝਾਨਾਂ ਨੂੰ ਬਹੁਤ ਜਿਆਦਾ ਪ੍ਰਭਾਵਿਤ ਕੀਤਾ ਐ ਕੁਝ ਪਾਤਰ ਅਜਿਹੀਆਂ ਹਨ ਜਿਹੜੀਆਂ ਮਤਲਬ ਕਿ ਕੱਪੜੇ ਬਹੁਤ ਸੋਹਣੇ ਪਾਉਂਦੀਆਂ ਨੇ ਤੇ ਆਪਣੇ ਵਿਰਸੇ ਨੂੰ ਬਹੁਤ ਅੱਗੇ ਵਧਾਉਣ ਲਈ ਗੱਲ ਕਰਦੀਆਂ ਨੇ ਆਪਣੇ ਪੰਜਾਬੀ ਫਿਲਮਾਂ ਦੇ ਵਿੱਚ ਜਿਵੇਂ ਬਹੁਤ ਸਾਰੇ ਅਜਿਹੇ ਪਾਤਰ ਨੇ ਜਿਹੜੇ ਮਤ ਬਹੁਤ ਵਧੀਆ ਫਿਲਮਾਂ ਬਣਾਉਂਦੇ ਨੇ ਤੇ ਫਿਲਮਾਂ ਦੇ ਵਿੱਚ ਤੇ ਪਰਿਵਾਰ ਦੇ ਵਿੱਚ ਬੈਠ ਕੇ ਦੇਖਣ ਵਾਲੀਆਂ ਫਿਲਮਾਂ ਆਉਂਦੀਆਂ ਨੇ ਤੇ ਇਹਨਾਂ ਫਿਲਮਾਂ ਤੋਂ ਬਹੁਤ ਸਾਰਾ ਆਨੰਦ ਵੀ ਮਿਲਦਾ ਤੇ ਬੱਚਿਆਂ ਨੂੰ ਵੱਡੇ ਵੱਡਿਆਂ ਨੂੰ ਜਵਾਨਾਂ ਨੂੰ ਸੇਧ ਵੀ ਮਿਲਦੀ ਹੈ ਪਰ ਜਿਹੜੀਆਂ ਪਹਿਲਾਂ ਫਿਲਮਾਂ ਸੀ ਉਹਨਾਂ ਵਿੱਚ ਪਰਿਵਾਰਿਕ ਸੀਗਾ ਜਿਹੜੀਆਂ ਹੁਣ ਫਿਲਮਾਂ ਨੇ ਉਹਨਾਂ ਵਿੱਚ ਪਰਿਵਾਰਿਕ ਮਹੱਤਤਾ ਨੂੰ ਘਟਾ ਦਿੱਤਾ ਗਿਆ ਜਿਆਦਾਤਰ ਹੁਣ ਵਾਲੀਆਂ ਜਿਹੜੀਆਂ ਫਿਲਮੀ ਪਾਤਰ ਨੇ ਜਿਵੇਂ ਔਰਤਾਂ ਹੋ ਗਈਆਂ ਨੀਰੂ ਬਾਜਵਾ ਇਹ ਆਪਣੇ ਇਹਨਾਂ ਨੇ ਪਹਿਰਾਵਾਂ ਇਨਾ ਜਿਆਦਾ ਘਟਾ ਦਿੱਤਾ ਜਿਹੜਾ ਕਿ ਸਾਡੀ ਵਿਰਸੇ ਨੂੰ ਆਉਣ ਆਉਣ ਵਾਲੀ ਪੀੜੀ ਨੂੰ ਵੀ ਖਰਾਬ ਕਰਦੇ ਆ ਇਹਨਾਂ ਨੇ ਸਿਰਫ ਪੈਸੇ ਨੂੰ ਤਰਜੀਹ ਦੇ ਰੱਖੀ ਆ ਆਪਣਾ ਜੋ ਵਿਰਸਾ ਐ ਇਹਨੂੰ ਖਤਮ ਕਰਨ ਤੇ ਲੱਗੇ ਹੋਏ ਹਨ ਇਹਨਾਂ ਨੂੰ ਬਹੁਤ ਘੱਟ ਕੱਪੜਿਆਂ ਦੇ ਵਿੱਚ ਪਸੰਦ ਕਰ ਰਹੇ ਨੇ ਲੋਕ ਜੋ ਮਤਲਬ ਕਿ ਨੌਜਵਾਨ ਪੀੜੀ ਐ ਕਿਉਂਕਿ ਇਹਨਾਂ ਨੂੰ ਕੱਪੜਿਆਂ ਦੇ ਵਿੱਚ ਐਵੇਂ ਦਿਖਾਇਆ ਜਾਂਦਾ ਹੈ ਜੋ ਕਿ ਇੱਕ ਖਿੱਚ ਦਾ ਕੇਂਦਰ ਬਣ ਜਾਂਦੀਆਂ ਨੇ ਨੌਜਵਾਨਾਂ ਲਈ ਉਹਨਾਂ ਨੂੰ ਨਹੀਂ ਪਤਾ ਹੁੰਦਾ ਉਹ ਸਿਰਫ ਉਹਨਾਂ ਦੀ ਮਤਲਬ ਕਿ ਸੁੰਦਰਤਾ ਦੇਖ ਲੈਂਦੇ ਨੇ ਕੱਪੜੇ ਦੇਖ ਲੈਂਦੇ ਨੇ ਜਿਹੜਾ ਕਿ ਸਾਡੇ ਲਈ ਆਉਣ ਵਾਲੇ ਸਮੇਂ ਲਈ ਬਹੁਤ ਘ ਘਾਤਕ ਸਿੱਧ ਹੋਣ ਵਾਲਾ ਐ ਮੈਂ ਤਾਂ ਇਹੀ ਗੁਜ਼ਾਰਿਸ਼ ਕਰਦੀ ਆਂ ਫਿਲਮਾਂ ਆਹੀਆਂ ਜਾਂ ਬਣਨੀਆਂ ਚਾਹੀਦੀਆਂ ਨੇ ਕਿ ਕੱ ਪਹਿਰਾਵਾ ਸੁੰਦਰ ਹੋਵੇ ਪਰ ਬਹੁਤ ਵਧੀਆ ਹੋਵੇ ਫਿਲਮ ਇਹੀ ਜਿਹੀ ਬਣਨੀ ਚਾਹੀਦੀ ਹੈ ਜਿਹਦੇ ਤੋਂ ਸਾਨੂੰ ਸੇਧ ਮਿਲੇ ਸਾਡੇ ਬੱਚਿਆਂ ਨੂੰ ਅੱਗੇ ਮਾਰਗ ਦਰਸ਼ਨ ਮਿਲੇ ਭੜਕਾਵੂ ਫਿਲਮਾਂ ਦਾ ਬੰਦ ਹੋਣਾ ਚਾਹੀਦਾ ਹੈ ਇਹਨਾਂ ਦਾ ਸਾਡੇ ਜੀਵਨ ਵਿੱਚ ਕੋਈ ਮਹੱਤਤਾ ਨਹੀਂ ਹੈ ਇਹਨਾਂ ਨੂੰ ਖਤਮ ਹੀ ਕਰਨਾ ਚਾਹੀਦਾ ਸਰਕਾਰ ਵੱਲੋਂ ਵੀ ਇਹਨਾਂ ਤੇ ਰੋਕ ਲਗਾਉਣੀ ਚਾਹੀਦੀ ਹੈ ਇਹ ਫਿਲਮਾਂ ਆਨੰਦ ਦਾ ਹੀ ਕੇਂਦਰ ਨਹੀਂ ਹੋਣੀਆਂ ਚਾਹੀਦੀਆਂ ਇਹ ਸੇ ਸਾਨੂੰ ਸਾਡੇ ਬੱਚਿਆਂ ਨੂੰ ਸਾਡੀ ਆਉਣ ਵਾਲੀ ਪੀੜੀ ਨੂੰ ਸੇਧ ਦੇਣ ਵਾਲਾ ਇੱਕ ਸਾਧਨ ਬਣਨਾ ਚਾਹੀਦਾ ਹੈ